ਜੇਕਰ ਅਸੀਂ ਪੜ੍ਹਾਈ ਦੀ ਗੱਲ ਕਰੀਏ ਤਾਂ ਅੱਜ ਦਾ ਦੌਰ ਪੜ੍ਹਾਈ ਦਾ ਦੌਰ ਹੈ ਕਿ ਹਰ ਬੰਦੇ ਨੂੰ ਹਰ ਪਰਸਨ ਨੂੰ ਹਰ ਧੀ ਨੂੰ ਹਰ ਦੋਸਤ ਨੂੰ ਹਰ ਭੈਣ ਨੂੰ ਹਰੇਕ ਨੌਲੇਜ ਹੋਣੀ ਚਾਹੀਦੀ ਹੈ ਸਿੱਖਿਆ ਦੇ ਮਾਮਲੇ 'ਚ ਕਿ ਉਹ ਕੀ ਕਰਨਾ ਚਾਹੁੰਦਾ ਕੀ ਨਹੀਂ ਕਰਨਾ ਚਾਹੁੰਦਾ ਜੇਕਰ ਮੈਂ ਆਪਣੇ ਭੈਣ ਦੀ ਗੱਲ ਕਰਾਂ ਤਾਂ ਮੇਰੀ ਭੈਣ ਪਲੱਸ ਟੂ ਕਰ ਚੁੱਕੀ ਹੈ ਮੈਂ ਹਮੇਸ਼ਾ ਹੀ ਉਸਨੂੰ ਇਹ ਗਾਈਡ ਕਰਦੀ ਹਾਂ ਕਿ ਅੱਗੇ ਪੜ੍ਹੋ ਕਿਉਂਕਿ ਮੈਂ ਖੁਦ ਗ੍ਰੈਜੂਏਸ਼ਨ ਆ ਅਤੇ ਮੈਂ ਇਹੀ ਕਹਿੰਦੀ ਆ ਕਿ ਅੱਗੇ ਪੜ੍ਹੋ ਅੱਗੇ ਵਧੋ ਆਪਣੀ ਲਾਈਫ 'ਚ ਆਪਣੇ ਕਾਬਿਲ ਬਣੋ ਕਿ ਕਿਸੇ 'ਤੇ ਡਿਪੈਂਡ ਰਹਿਣਾ ਬਹੁਤ ਔਖਾ ਅੱਜ ਦਾ ਦੌਰ ਇੰਡੀਪੈਂਡੈਂਟ ਦੌਰ ਹੈ ਕਿ ਹਰ ਕੋਈ ਪਰਸਨ ਆਪਣੇ ਪੈਰਾਂ 'ਤੇ ਖੜਾ ਹੋਣਾ ਚਾਹੁੰਦਾ ਹੈ ਪਰ ਜੇਕਰ ਮੈਂ ਗੱਲ ਕਰਾਂ ਸਿੱਖਿਆ ਪ੍ਰਾਪਤ ਕਿਉਂ ਕਰਨੀ ਚਾਹੀਦੀ ਹੈ ਕਿਉਂ ਬਹੁਤ ਹੀ ਜ਼ਰੂਰੀ ਹੈ ਕਿ ਹਰ ਕੁੜੀ ਨੂੰ ਆਪਣੇ ਪੈਰਾਂ 'ਤੇ ਖੜਾ ਹੋਣਾ ਚਾਹੀਦਾ ਹੈ ਕਿ ਜੇਕਰ ਹਰ ਔਰਤ ਹਰ ਕੁੜੀ ਹਰ ਪਰਸਨ ਇਸ ਗੱਲ ਨੂੰ ਸਮਝੇਗਾ ਤੋਂ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ਼ ਜੀਅ ਸਕੇਗਾ ਕਿ ਅੱਜ ਕੱਲ੍ਹ ਅਨਪੜ੍ਹ ਪਰਸਨ ਨੂੰ ਕੁਝ ਵੀ ਨਹੀਂ ਸਮਝਿਆ ਜਾਂਦਾ ਕਿ ਜੇਕਰ ਲੜਕੀਆਂ ਦੀ ਸਿੱਖਿਆ ਦੇ ਮਾਮਲੇ 'ਚ ਮੁਸ਼ਕਿਲਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਹੁੰਦੀਆਂ ਨੇ ਕੇ ਉਹਨਾਂ ਵਿੱਚੋਂ ਜਿੱਦਾਂ ਕੁਝ ਮੁਸ਼ਕਿਲਾਂ ਕਿ ਸਭ ਤੋਂ ਪਹਿਲਾਂ ਘਰ ਦੇ ਮਾਪੇ ਮਾਪੇ ਕਈ ਵਾਰੀ ਸੋਚਦੇ ਨੇ ਕਿ ਅਸੀਂ ਬਸ ਜਿੰਨਾ ਪੜ੍ਹਾ ਲਿਆ ਓਨਾ ਪੜ੍ਹਾ ਲਿਆ ਬਹੁਤ ਹੈ ਜੇਕਰ ਅਸੀਂ ਉਸ ਤੋਂ ਵੱਧ ਨਹੀਂ ਪੜ੍ਹਾ ਸਕਦੇ ਹੈ ਨਾ ਕਿ ਸਾਡੇ ਅਸੀਂ ਵਿਆਹ ਦੀ ਏ ਸਾਡੇ ਸਿਰੋਂ ਭਾਰ ਲੱਥੇ ਵਗੈਰਾ ਵਗੈਰਾ ਕਿਉਂਕਿ ਇਹ ਸੋਚ ਅੱਜ ਦੇ ਦੌਰ ਵਿੱਚ ਵੀ ਬਹੁਤ ਜ਼ਿਆਦਾ ਏ ਕਿ ਬਹੁਤ ਜ਼ਿਆਦਾ ਲੋਕ ਇਹ ਗੱਲਾਂ ਨੂੰ ਸੋਚਦੇ ਨੇ ਪਰ ਮੈਂ ਚਾਹੁੰਦੀ ਹਾਂ ਕਿ ਹਰ ਕੁੜੀ ਹਰ ਧੀ ਹਰ ਭੈਣ ਹਰ ਦੋਸਤ ਪੜ੍ਹੇ ਆਪਣੇ ਪੈਰਾਂ 'ਤੇ ਸਟੈਂਡ ਹੋਵੋ ਕੈ ਦੂਜੀ ਕਈ ਵਾਰੀ ਬੱਚਿਆਂ ਨੂੰ ਭੈਣਾਂ ਨੂੰ ਜਾਂ ਦੋ ਦੋਸਤਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਕਿ ਸਾਨੂੰ ਪੜ੍ਹਨ ਦਾ ਮੌਕਾ ਤਾਂ ਮਿਲ ਜਾਂਦਾ ਪਰ ਸਾਡੀਆਂ ਕੋਲੇਜ ਯੂਨੀਵਰਸਿਟੀਆਂ ਸਾਡੇ ਤੋਂ ਬਹੁਤ ਦੂਰ ਪੈ ਜਾਂਦੀਆਂ ਕਿਉਂਕਿ ਪਿੰਡਾਂ ਵਿੱਚ ਇਹ ਸਾਰੀਆਂ ਗੱਲਾਂ ਬਹੁਤ ਕੁਝ ਮਤਲਬ ਮਾਇਨੇ ਰੱਖਦੀਆਂ ਨੇ ਬਹੁਤ ਸਾਰੇ ਲੋਕ ਸੋਚਦੇ ਇੰਨੀ ਦੂਰ ਜਾਣ ਨਾਲੋਂ ਚੰਗਾ ਕਿ ਅਸੀਂ ਨਾ ਹੀ ਪੜ੍ਹਾਈਏ ਕਿ ਉਹਨਾਂ ਦੀ ਸਕਿਊਰਟੀ ਦੀ ਟੈਨਸ਼ਨ ਹੋ ਜਾਂਦੀ ਹੈ ਪੇਰੈਂਟਸ ਨੂੰ ਹੈ ਨਾ ਇਹ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੁੜੀਆਂ ਨੂੰ ਬਹੁਤ ਜ਼ਿਆਦਾ ਕਰਨਾ ਪੈਂਦਾ ਪਰ ਮੈਂ ਲਾਸਟ ਇਹੀ ਗੱਲ ਕਹੂੰਗੀ ਕਿ ਹਰ ਪਰਸਨ ਨੂੰ ਪੜ੍ਹਨਾ ਜ਼ਰੂਰੀ ਆ ਉਹ ਭਾਵੇਂ ਧੀ ਹੈ ਭੈਣ ਹੈ ਦੋਸਤ ਹੈ ਕੋਈ ਵੀ ਹੈ ਇੰਡੀਪੈਂਡੈਂਟ ਰਹੋ ਡਿਪੈਂਡੈਂਟ ਨਾ ਰਹੋ ਅੱਜ ਦਾ ਦੌਰ ਇੰਡੀਪੈਂਡੈਂਟ ਦੌਰ ਹੈ ਪੜ੍ਹੋ ਲਿਖੋ ਆਪਣੇ ਪੈਰਾਂ 'ਤੇ ਸਟੈਂਡ ਹੋਵੋ ਅਤੇ ਇਸੇ ਲਈ ਮੈਂ ਆਪਣੀ ਭੈਣ ਨੂੰ ਵੀ ਇਹੀ ਸੁਝਾਅ ਦਊਂਗੀ ਕਿ ਉਹ ਪੜ੍ਹੇ ਲਿਖੇ ਅਤੇ ਆਪਣੇ ਪੈਰਾਂ 'ਤੇ ਖੁਦ ਖੜੀ ਹੋਵੇ